ਭੰਗੜਾ ਸਾਡੀ ਸਾਡੀ ਆਨ ਸ਼ਾ ਆਨ ਬਾਨ ਸ਼ਾਨ ਲਈ ਸਾਡਾ ਭੰਗੜਾ ਬਹੁਤ ਜ਼ਰੂਰੀ ਹੈ ਭੰਗੜਾ ਹਰ ਤਿਉਹਾਰ ਵਿਆਹ ਸ਼ਾਦੀ ਅਤੇ ਜਨਮ ਦੇ ਮੌਕੇ 'ਤੇ ਪਾਇਆ ਜਾਂਦਾ ਹੈ ਇਹ ਭੰਗੜਾ ਇਕ ਅਜਿਹਾ ਹੈ ਜਿਹੜਾ ਢੋਲ ਦੀ ਤਾਲ 'ਤੇ ਹੀ ਪਾਇਆ ਜਾਂਦਾ ਹੈ ਭੰਗੜੇ ਭੰਗੜੇ ਦੇ ਵਿੱਚ ਪੰਜਾਬੀ ਬੰਦਾ ਆਟੋਮੈਟਿਕ ਹੀ ਭੰਗੜਾ ਪਾਉਣ ਲੱਗ ਜਾਂਦਾ ਹੈ ਭੰਗੜਾ ਸਾਡੇ ਤਿਉਹਾਰਾਂ ਫਸਲ ਉਗਾਉਣ ਕੱਟਣ ਦੇ ਵਿੱਚ ਬਹੁਤ ਮਸ਼ਹੂਰ ਹੈ ਲੋਹੜੀ 'ਤੇ ਮੁੰਡਾ ਹੋਣ 'ਤੇ ਲੋਹੜੀ 'ਤੇ ਭੰਗੜਾ ਬਹੁਤ ਪਾਇਆ ਜਾਂਦਾ ਹੈ ਹੁਣ ਵਿਸਾਖੀ ਦਾ ਤਿਉਹਾਰ ਆਉਣ ਵਾਲਾ ਹੈ ਵਿਸਾਖੀ 'ਤੇ ਤਿਉਹਾਰ 'ਤੇ ਭੰਗੜਾ ਪਾਇਆ ਜਾਂਦਾ ਹੈ ਇਹ ਫਸਲ ਕੱਟਣ ਦੀ ਖੁਸ਼ੀ ਵਿੱਚ ਪਾਇਆ ਜਾਂਦਾ ਹੈ ਭੰਗੜਾ ਸਾਡੇ ਸਰੀਰ ਦੇ ਐਕਸਰਸਾਈਜ਼ ਵਾਸਤੇ ਵੀ ਬਹੁਤ ਜ਼ਰੂਰੀ ਹੈ